ਹੈਲੋ ਹਾਂਜੀ ਭਾਅ ਜੀ ਮੈਂ ਨਾ ਕੋਕੋਨਟ ਹੇਅਰ ਓਇਲ ਤੁਹਾਡੀ ਕੰਪਨੀ ਤੋਂ ਖਰੀਦਿਆ ਸੀ ਖਰੀਦਿਆ ਮੈਂ ਮਾਰਕੀਟ ਤੋਂ ਸੀ ਪਰ ਉਹਦੇ ਵਿੱਚ ਉੱਲੀ ਲੱਗੀ ਹੋਈ ਹੈ ਹਾਂਜੀ ਓਇਲ ਉੱਪਰੋਂ ਤਾਂ ਠੀਕ ਸੀ ਪਰ ਉਹਦੇ ਨੀਚੋਂ ਉਹ ਪੂਰਾ ਵਾਈਟ ਸੀ ਔਰ ਬੜੇ ਉਹਦੇ ਜਾਲੇ ਵੱਜੇ ਹੋਏ ਸੀ ਮੈਂ ਸ਼ੌਪਕੀਪਰ ਕੋਲ ਗਈ ਸੀ ਦੁਬਾਰਾ ਉਹਨੂੰ ਮੈਂ ਕਿਹਾ ਸੀ ਕਿ ਇਹਨੂੰ ਚੇਂਜ ਕਰੋ ਲੇਕਿਨ ਉਹ ਕਹਿ ਰਹੇ ਕਿ ਅਸੀਂ ਚੇਂਜ ਨਹੀਂ ਕਰਨਾ ਇਹ ਕੰਪਨੀ ਦਾ ਮਾਲ ਹੈ ਕੰਪਨੀ ਹੀ ਅਕਸਚੇਂਜ ਕਰੇਗੀ ਤੁਸੀਂ ਉਹਨਾਂ ਨੂੰ ਕਸਟਮਰ ਕੇਅਰ 'ਤੇ ਫ਼ੋਨ ਕਰੋ ਠੀਕ ਹੈ ਹਾਂਜੀ ਹਾਂਜੀ ਮੈਂ ਇੱਥੋਂ ਲੋਕਲ ਕੰਪਨੀ ਤੋਂ ਇੱਥੋਂ ਮਾਰਕੀਟ ਤੋਂ ਹੀ ਖਰੀਦਿਆ ਸੀ ਹਾਂਜੀ ਕਰਿਆਨਾ ਸਟੋਰ ਹੈ ਉਹ ਢਾਬ 'ਤੇ ਹੈ ਹਾਂਜੀ ਹਾਂਜੀ ਉੱਥੋਂ ਹੀ ਖਰੀਦਿਆ ਸੀ ਬਿਲਕੁਲ ਅਤੇ ਉਹਨਾਂ ਨੇ ਸਾਡੀ ਪ੍ਰੋਡਕਟ ਵਾਪਸ ਨਹੀਂ ਕੀਤਾ ਠੀਕ ਹੈ ਉਹ ਕਹਿੰਦੇ ਕਸਟਮਰ ਕੇਅਰ 'ਤੇ ਫ਼ੋਨ ਕਰੋ ਕਸਟਮਰ ਕੇਅਰ 'ਤੇ ਅਸੀਂ ਫ਼ੋਨ ਕੀਤਾ ਉਹ ਕਹਿੰਦੇ ਜੀ ਉਹਨਾਂ ਨੇ ਸਾਰੀ ਇਨਫੋਰਮੇਸ਼ਨ ਦਿੱਤੀ ਕਿੱਥੋਂ ਲਿਤਾ ਹੈ ਕਿੰਨਰ ਕਦੋਂ ਲਿੱਤਾ ਹੈ ਕਿੰਨਾ ਐੱਮ ਐੱਲ ਹੈ ਸਾਰੀ ਇਨਫੋਰਮੇਸ਼ਨ ਉਹਨਾਂ ਨੂੰ ਦੇ ਦਿੱਤੀ ਅਸੀਂ ਠੀਕ ਹੈ ਫਿਰ ਉਹ ਉਹਨਾਂ ਨੇ ਫਿਰ ਸਾਡੀ ਅੱਗੋਂ ਹੋਰ ਕਿਸੇ ਨਾਲ ਗੱਲ ਕਰਵਾਈ ਉਹਨਾਂ ਨਾਲ ਗੱਲ ਕਰਵਾਈ ਫਿਰ ਉਹਨਾਂ ਨੇ ਇਨਫੋਰਮੇਸ਼ਨ ਲਿੱਤੀ ਸਾਡੇ ਕੋਲੋਂ ਫਿਰ ਜੀ ਚਲੋ ਕਰ ਕਰਾ ਕੇ ਉਹਨਾਂ ਨੇ ਪ੍ਰੋਡਕਟ ਕਹਿੰਦੇ ਸਾਨੂੰ ਅਸੀਂ ਰਿਟਰਨ ਪਾ ਦਿੰਦੇ ਹਾਂ ਤੁਹਾਡੇ ਕੋਲ ਇੱਕ ਆਏਗਾ ਸਾਡਾ ਆਦਮੀ ਉਹ ਲੈ ਜਾਏਗਾ ਉਹ ਤੁਹਾਨੂੰ ਨਵਾਂ ਪ੍ਰੋਡਕਟ ਸਾਨੂੰ ਵਾਪਸ ਦੇ ਜਾਏਗਾ ਚਲੋ ਥੋੜ੍ਹੇ ਦਿਨਾਂ ਬਾਅਦ ਆਇਆ ਤਿੰਨ ਚਾਰ ਦਿਨ ਮੇ ਬੀ ਲੱਗੇ ਹੋਣਗੇ ਉਹਨਾਂ ਨੂੰ ਉਹ ਆਇਆ ਸਾਨੂੰ ਓਇਲ ਦੇਣ ਵਾਸਤੇ ਵਾਪਸ ਓਇਲ ਉਹਨਾਂ ਨੇ ਐਕਸਚੇਂਜ ਕਰ ਲਿਆ ਪੁਰਾਣਾ ਲੈ ਗਏ ਉਹਨਾਂ ਨੂੰ ਮੈਂ ਦਿਖਾਇਆ ਵੀ ਜਦੋਂ ਆਏ ਹੈ ਕਿ ਆ ਸਾਰਾ ਓਇਲ ਕਿਸ ਤਰ੍ਹਾਂ ਖ਼ਰਾਬ ਹੋਇਆ ਹੋਇਆ ਨੀਚੇਓ ਔਰ ਉਹ ਵਾਪਸ ਲੈ ਗਏ ਨਵਾਂ ਪ੍ਰੋਡਕਟ ਉਹਨਾਂ ਨੇ ਪੈਕ ਕਰਕੇ ਦਿੱਤਾ ਅਸੀਂ ਆਪਣੇ ਕੋਲ ਰੱਖ ਲਿਆ ਜਦੋਂ ਉਹ ਪੈਕਿੰਗ ਖੋਲ੍ਹੀ ਹੈ ਉਹਦੇ ਵਿੱਚ ਫਿਰ ਸੇਮ ਪ੍ਰੋਬਲਮ ਹੈ ਇਹ ਕੋਈ ਤਰੀਕਾ ਥੋੜ੍ਹੀ ਹੈ ਅਸੀਂ ਪਾਗਲ ਆ ਜਿਹੜੇ ਤੁਹਾਡੇ ਅਸੀਂ ਵਾਰ ਵਾਰ ਇੱਕੋ ਹੀ ਚੀਜ਼ ਨੂੰ ਅਸੀਂ ਵਾਰ ਵਾਰ ਖ਼ਰਾਬ ਲਈ ਜਾਈਏ ਔਰ ਵਾਰ ਵਾਰ ਤੁਹਾਨੂੰ ਵਾਪਸ ਕਰੀ ਜਾਈਏ ਅਸੀਂ ਇਹੀ ਕੰਮ ਕਰਨੇ ਹੈ ਜੇ ਮਾਰਕੀਟ ਤੋਂ ਉਹ ਚੀਜ਼ ਲਵੇ ਤਾਂ ਵੀ ਉਹੀ ਹਾਲ ਆ ਜੇ ਔਨਲਾਈਨ ਮੰਗਾਓ ਤਾਂ ਵੀ ਉਹੀ ਹਾਲ ਆ ਤੁਸੀਂ ਹੁਣ ਸਾਨੂੰ ਵਾਪਿਸ ਕਰਨਾ ਉਹ ਪ੍ਰੋਡਕਟ ਸਹੀ ਤਰੀਕੇ ਦੇ ਨਾਲ ਅੱਛੀ ਕੁਆਲਿਟੀ ਦਾ ਜਾਂ ਨਹੀਂ ਕਰਨਾ ਅਗਰ ਨਹੀਂ ਕਰਨਾ ਅਸੀਂ ਕਸਟਮਰ ਕੇਅਰ 'ਤੇ ਫਿਰ ਦੁਬਾਰਾ ਸ਼ਿਕਾਇਤ ਕਰ ਦਿੰਦੇ ਹਾਂ ਲੇਬਰ ਕੋਰਟ 'ਚ ਜਾ ਕੇ ਅਸੀਂ ਉਹਨੂੰ ਪ੍ਰੋਡਕਟ ਦਿਖਾ ਕੇ ਆਉਂਦੇ ਹਾਂ ਸਾਡੇ ਕੋਲ ਤਾਂ ਬਹੁਤ ਤਰੀਕੇ ਹੈਗੇ ਤੁਹਾਡੀ ਕੰਪਨੀ ਤੋਂ ਅੱਛਾ ਵਾਪਸ ਲੈਣ ਦਾ ਪ੍ਰੋਡਕਟ ਪਰ ਅਸੀਂ ਨਾ ਖੁਦ ਖੱਜਲ ਖ਼ਰਾਬ ਹੋਣਾ ਚਾਹੁੰਦੇ ਹਾਂ ਨਾ ਤੁਹਾਨੂੰ ਕਰਨਾ ਚਾਹੁੰਦੇ ਹਾਂ ਇਸ ਲਈ ਤੁਹਾਨੂੰ ਲਾਸਟ ਅਲਟੀਮੇਟਮ ਦੇ ਰਹੇ ਹਾਂ ਜੀ ਤੁਸੀਂ ਜਾਂ ਤਾਂ ਪ੍ਰੋਡਕਟ ਸਾਨੂੰ ਅੱਛੀ ਤਰੀਕੇ ਦੀ ਕੁਆਲਿਟੀ ਦਾ ਦਿਓ ਜਿਹੜਾ ਬਿਲਕੁਲ ਸਹੀ ਹੋਵੇ ਅਦਰਵਾਈਜ਼ ਸਾਡੇ ਕੋਲ ਔਪਸ਼ਨਸ ਬਹੁਤ ਹੈਗੀਆਂ ਅਸੀਂ ਆਪਣੇ ਕਸਟਮਰ ਕੇਅਰ ਅਤੇ ਲੇਬਰ ਕੋਰਟ 'ਚ ਜਾ ਕੇ ਅਸੀਂ ਤੁਹਾਡੇ ਪ੍ਰੋਡਕਟ ਨੂੰ ਦੇ ਕੇ ਤੁਹਾਡੀ ਕੁਆਲਿਟੀ ਚੈੱਕ ਕਰਵਾ ਕੇ ਤੁਹਾਡੇ ਉੱਤੇ ਕੇਸ ਕਰ ਦਾਂਗੇ ਫਿਰ ਤੁਹਾਨੂੰ ਪਤਾ ਹੀ ਆ ਜਦੋਂ ਕੇਸ ਹੁੰਦੇ ਤਾਂ ਫਿਰ ਕੀ ਹਾਲ ਹੁੰਦਾ ਹੈ ਉਹ ਤੁਸੀਂ ਆਪੇ ਤਰੀਕਾਂ ਭੁਗਤੋ ਅਸੀਂ ਤਾਂ ਵਿਹਲੇ ਹਾਂ ਅਸੀਂ ਤਾਂ ਤਰੀਕਾਂ ਭੁਗਤ ਲੈਣੀਆਂ ਜੇ ਤਾਂ ਹੁਣ ਤੁਸੀਂ ਆਪਣਾ ਦੇਖੋ ਤੁਸੀਂ ਕੀ ਕਰਨਾ ਅਤੇ ਕੀ ਨਹੀਂ ਕਰਨਾ ਵੈਸੇ ਤੁਸੀਂ ਸਾਨੂੰ ਇਹ ਦੱਸੋ ਕਿ ਕਿੰਨੇ ਦਿਨਾਂ ਵਿੱਚ ਸਾਨੂੰ ਪ੍ਰੋਡਕਟ ਮਿਲੇਗਾ ਉਨੇ ਦਿਨਾਂ ਵਿੱਚ ਸਾਡੇ ਕੋਲ ਆਉਣਾ ਚਾਹੀਦਾ ਔਰ ਅੱਛੀ ਕੁਆਲਿਟੀ ਦਾ ਆਉਣਾ ਚਾਹੀਦਾ ਸਾਡੇ ਕੋਲ ਫਰੀ ਇੰਨਾ ਟਾਈਮ ਨਹੀਂ ਹੈਗਾ ਸੀ ਕਿ ਤੁਹਾਨੂੰ ਵਾਰ ਵਾਰ ਕੋਲਸ ਕਰੀ ਜਾਈਏ ਕਦੀ ਕਿਸੇ ਨੂੰ ਕੋਲ ਕਰੋ ਕਦੀ ਕਿਸੇ ਨੂੰ ਕੋਲ ਕਰੋ ਕੋਲਸ ਕਰਨ ਵਾਸਤੇ ਸਾਡੇ ਕੋਲ ਟਾਈਮ ਨਹੀਂ ਹੈਗਾ ਇੱਥੇ ਤੁਸੀਂ ਲਾਸਟ ਤੁਹਾਨੂੰ ਟਾਈਮ ਦਿੱਤਾ ਹੈ ਤੁਸੀਂ ਆਪਣਾ ਪ੍ਰੋਡਕਟ ਦਿਓ ਅਤੇ ਸਾਨੂੰ ਫਾਇਰ ਕਰੋ